ਅੱਜ ਕੱਲ੍ਹ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ਼ ਜਿਹੜੇ ਹੈਗੇ ਆ ਟੂਰਨਾਮੈਂਟ ਕੀਤੇ ਜਾਂਦੇ ਹਨ ਜੋ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹਨ ਜਿਨ੍ਹਾਂ ਵਿੱਚੋਂ ਪੰਜਾਬੀ ਦੀ ਮਾਂ ਖੇਡ ਜਿਵੇਂ ਆਪਾਂ ਕਬੱਡੀ ਕਹਿੰਦੇ ਸੀ ਉਹ ਪੰਜਾਬ ਦੇ ਵਿੱਚ ਜਿਹੜਾ ਹੈਗਾ ਟੂਰਨਾਮੈਂਟ ਜਿਹੜਾ ਹੈਗਾ ਉਹ ਕਰਵਾਇਆ ਜਾਂਦਾ ਹੈ ਉਹ ਰਾਸ਼ਟਰੀ ਵੀ ਹੈ ਅਤੇ ਅੰਤਰਰਾਸ਼ਟਰੀ ਵੀ ਹੁੰਦਾ ਹੈ ਜਿਹੜੇ ਕਿ ਸਾਨੂੰ ਆਪਣੇ ਵਿਰਸੇ ਨਾਲ ਸਾਨੂੰ ਜੋੜਦੇ ਹਨ ਅਤੇ ਇਸ ਕਰਕੇ ਜਿਹੜੇ ਜਿਹੜੇ ਟੂਰਨਾਮੈਂਟ ਹੈਗੇ ਹੈ ਭਾਵੇਂ ਹਾਕੀ ਹੈ ਜਾਂ ਹੋਰ ਤਰੀਕੇ ਦੇ ਕਈ ਹਨ ਬੈਲ ਗੱਡੀ ਰੇਸ ਹੈਗੀ ਹੈ ਜੋ ਕਿ ਸਾਡੇ ਪੇਂਡੂ ਵਿਰਸੇ ਨਾਲ ਸੰਬੰਧਿਤ ਹੈ ਉਹ ਸਾਰੇ ਪ੍ਰਕਾਰ ਦੀਆਂ ਜਿਹੜੀਆਂ ਹੈਂਗੀਆਂ ਹੈਂਗੀਆਂ ਖੇਡਾਂ ਹੈਂਗੀਆਂ ਹੈਂਗੀਆਂ ਉਹ ਸਾਡੇ ਪੰਜਾਬ ਦੇ ਵਿੱਚ ਇੱਕ ਤਾਂ ਸਾਡੇ ਸ ਸਾਨੂੰ ਸੱਭਿਆਚਾਰ ਨਾਲ਼ ਜੋੜਦੀਆਂ ਹਨ ਅਤੇ ਸਾਨੂੰ ਆਪਣੇ ਪਿਛੋਕੜ ਦੀ ਯਾਦ ਦਿਵਾਉਂਦੀਆਂ ਹਨ ਅਜਿਹੇ ਖੇਡ ਮੇਲੇ ਜਿਹੜੇ ਹੈਗੇ ਆ ਸਾਨੂੰ ਆਯੋਜਿਤ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬ ਦੇ ਵਿੱਚ ਪੰਜਾਬ ਦਾ ਸਰਵਪੱਖੀ ਵਿਕਾਸ ਹੋ ਸਕੇ ਧੰਨਵਾਦ